ਤੇਈ ਅਕਤੂਬਰ ਉੱਨੀ ਸੌ ਚੁਹੱਤਰ ਅੱਠ ਜੂਨ ਦੋ ਹਜ਼ਾਰ ਅੱਠ ਚਾਰ ਅਗਸਤ ਦੋ ਹਜ਼ਾਰ ਨੌ ਅੱਠ ਦਸੰਬਰ ਦੋ ਹਜ਼ਾਰ ਦਸ ਦਸ ਜਨਵਰੀ ਦੋ ਹਜ਼ਾਰ ਗਿਆਰਾਂ